ਮੈਂ ਇਹ ਸੋਚਦਾ ਹਾਂ ਕਿ ਮੇਰੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਹਨ ਅਤੇ ਕੁਛ ਕਮਜ਼ੋਰੀਆਂ ਵੀ ਹਨ ਹਰ ਇਨਸਾਨ ਇੱਕ ਗਲਤੀਆਂ ਦਾ ਕਠਪੁਤਲਾ ਹੈ ਅਤੇ ਮੈਂ ਇਹ ਮੰਨਦਾ ਹਾਂ ਕਿ ਹਰ ਇਨਸਾਨ ਵਿੱਚ ਕਮਜ਼ੋਰੀਆਂ ਹੁੰਦੀਆਂ ਹਨ ਮੇਰੀਆਂ ਕੁਛ ਸ਼ਕਤੀਆਂ ਹਨ ਜਿਵੇਂ ਕਿ ਮੈਂ ਮਿੱਠੀ ਬੋਲੀ ਦਾ ਪ੍ਰਯੋਗ ਕਰਦਾ ਹਾਂ ਮੈਂ ਹਰ ਇਨਸਾਨ ਨਾਲ ਪਿਆਰ ਦੇ ਨਾਲ ਰਹਿੰਦਾ ਹਾਂ ਵੱਡਿਆਂ ਦਾ ਵੱਡਿਆਂ ਨੂੰ ਇੱਜ਼ਤ ਦਿੰਦਾ ਹਾਂ ਛੋਟਿਆਂ ਨੂੰ ਪਿਆਰ ਕਰਦਾ ਹਾਂ ਸਭ ਦਾ ਸਤਿਕਾਰ ਕਰਦਾ ਹਾਂ ਹਰ ਕੰਮ ਨੂੰ ਸਮੇਂ ਸਿਰ ਨਿਪਟਾਉਣ ਦੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਸਵੇਰੇ ਉੱਠ ਕੇ ਪਾਠ ਕਰਦਾ ਹਾਂ ਪਾਠ ਕਰਨ ਨਾਲ ਮੈਨੂੰ ਬਹੁਤ ਵੱਡੀ ਸ਼ਕਤੀ ਮਿਲਦੀ ਹੈ ਕਿ ਮੈਂ ਹਰ ਇੱਕ ਕੰਮ ਨੂੰ ਬੜੇ ਪੋਜ਼ੀਟਿਵ ਤਰੀਕੇ ਦੇ ਨਾਲ ਕਰ ਸਕਦਾ ਹਾਂ ਪਾਠ ਕਰਨ ਨਾਲ ਮੇਰੀ ਸਾਰੇ ਡਰ ਦੂਰ ਹੋ ਜਾਂਦੇ ਹਨ ਮੈਨੂੰ ਕਿਸੇ ਵੀ ਚੀਜ਼ ਤੋਂ ਡਰ ਨਹੀਂ ਲੱਗਦਾ ਮੈਂ ਰੱਬ ਦਾ ਨਾਂ ਲੈ ਕੇ ਕੰਮ ਸ਼ੁਰੂ ਕਰਦਾ ਹਾਂ ਅਤੇ ਸਾਰੇ ਕੰਮ ਆਪੇ ਹੀ ਹੋ ਜਾਂਦੇ ਹਨ ਅਤੇ ਇੱਕ ਮੇਰੀ ਸ਼ਕਤੀ ਇਹ ਹੈ ਕਿ ਮੈਂ ਨੈਗਟਿਵ ਚੀਜ਼ ਨੂੰ ਵੀ ਬੜੇ ਪੋਜ਼ੀਟਿਵ ਵੇਅ ਦੇ ਨਾਲ ਲੈ ਕੇ ਉਸਨੂੰ ਕਰਦਾ ਹਾਂ ਉਹ ਵੀ ਮੇਰੀ ਇੱਕ ਬਹੁਤ ਵੱਡੀ ਸ਼ਕਤੀ ਹੈ ਮੇਰੀ ਇੱਕ ਕਮਜ਼ੋਰੀ ਇਹ ਹੈ ਕਿ ਮੇਰੇ ਵਿੱਚ ਪੇਸ਼ੈਂਸ ਥੋੜ੍ਹੀ ਘੱਟ ਹੈ ਕੋਈ ਮੁਸੀਬਤ ਆਉਂਦੀ ਹੈ ਤਾਂ ਮੈਂ ਹੜ ਬੜਾ ਹੜਬੜਾਹਟ ਵਿੱਚ ਗਲਤ ਫੈਸਲੇ ਲੈ ਜਾਂਦਾ ਹਾਂ ਜਿਸ ਨਾਲ ਕਿ ਕਈ ਵਾਰੀ ਮੈਨੂੰ ਹਰਜਾਨਾ ਵੀ ਭਰਨਾ ਪਿਆ ਹੈ ਸੋ ਆਪਣੀ ਕਮਜ਼ੋਰੀਆਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਿਵੇਂ ਖਤਮ ਕਰਨਾ ਹੈ ਇਹ ਸਾਨੂੰ ਜਾਣਨਾ ਚਾਹੀਦਾ ਹੈ ਕਿਉਂਕਿ ਸਾਡੀ ਕਮਜ਼ੋਰੀਆਂ ਹੀ ਸਾਡੀਆਂ ਸ਼ਕਤੀਆਂ ਬਣਦੀਆਂ ਹਨ